ਮੈਂ ਆਉਣ ਵਾਲੇ ਅੰਤਰਰਾਸ਼ਟਰੀ ਫ਼ੋਟੋਗ੍ਰਾਫ਼ੀ ਮੁਕਾਬਲੇ ਵਿੱਚ ਭਾਗ ਲੈਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਫ਼ੋਟੋਗ੍ਰਾਫ਼ੀ ਕਰਨ ਦਾ ਸ਼ੌਕ ਹੈ ਅਤੇ ਮੇਰੇ ਦੋਸਤ ਅਤੇ ਮੇਰੇ ਪਰਿਵਾਰਕ ਮੈਂਬਰ ਮੇਰੀਆਂ ਖਿੱਚੀਆਂ ਹੋਈਆਂ ਫ਼ੋਟੋਆਂ ਦੀ ਬਹੁਤ ਹੀ ਜ਼ਿਆਦਾ ਤਾਰੀਫ ਕਰਦੇ ਹਨ ਅਤੇ ਮੈਨੂੰ ਮੋਟੀਵੇਟ ਕਰਦੇ ਹਨ ਅਤੇ ਨਾਲ ਹੀ ਨਾਲ ਮੈਨੇ ਹੁਣ ਤੱਕ ਮੇਰੀਆਂ ਪੰਜ ਤੋਂ ਛੇ ਸਾਲ ਪੁਰਾਣੀਆਂ ਫ਼ੋਟੋਆਂ ਸਾਂਭ ਕੇ ਰੱਖੀਆਂ ਹਨ ਅਤੇ ਫ਼ੋਟੋਗ੍ਰਾਫ਼ੀ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਅਗਰ ਕੋਈ ਵੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਮੁਕਾਬਲਾ ਆਉਂਦਾ ਹੈ ਤਾਂ ਉਸ ਵਿੱਚ ਭਾਗ ਲੈਣਾ ਚਾਹੁੰਨਾ ਹਾਂ